ਖੇਡਾਂ ਖੇਡਣ ਨਾਲ ਪੇਂਡੂ ਖੇਤਰਾਂ ਵਿੱਚ ਬਹੁਤ ਵਿਕਾਸ ਹੋਇਆ ਹੈ ਇਨ੍ਹਾਂ ਦੇ ਬਹੁਤ ਲਾਭ ਹੁੰਦੇ ਹਨ ਇੱਕ ਤਾਂ ਪਿੰਡਾਂ ਵਿੱਚ ਨਸ਼ਿਆਂ ਤੋਂ ਮੁਕਤੀ ਮਿਲਦੀ ਹੈ ਇਨ੍ਹਾਂ ਨਾਲ ਅਤੇ ਦੂਸਰਾ ਹਰੇਕ ਬੱਚੇ ਦਾ ਸਰੀਰਕ ਬਨਾਵਟ ਵਧੀਆ ਰਹਿੰਦੀ ਹੈ ਉਸ ਨੂੰ ਮਾ ਕ੍ਰਿਤੀਆਂ ਤੋਂ ਦੂਰ ਰੱਖਦੀਆਂ ਹਨ ਖੇਡਾਂ ਖੇਡਾਂ ਵਿੱਚ ਮੰਨੋਰੰਜਨ ਵੀ ਹੁੰਦਾ ਹੈ ਸੱਭਿਆਚਾਰ ਵੀ ਹੁੰਦਾ ਸਾਰਾ ਕੁਛ ਹੁੰਦਾ ਹੈ ਇਨ੍ਹਾਂ ਵਿੱਚ ਲੋਕਾਂ ਦਾ ਆਪਸੀ ਇੱਕ ਦੂਸਰੇ ਪਿੰਡ ਵਿੱਚ ਜਾ ਕੇ ਖੇਡਾਂ ਦਾ ਦੇਖਣਾ ਮਾਹੌਲ ਵਿੱਚ ਸਾਫ ਸੁਥਰਾ ਮਾਹੌਲ ਵਿੱਚ ਖੇਡਾਂ ਦੇਖਣੀਆਂ ਜਾ ਕੇ ਉਹਦੇ ਨਾਲ ਭਾਈਚਾਰਕ ਸਾਂਝ ਵੀ ਬਹੁਤ ਵੱਧਦੀ ਹੈ ਇੱਕ ਦੂਜੇ ਦੇ ਪਿੰਡਾਂ ਵਿੱਚ ਜਾ ਕੇ ਹੱਸਣਾ ਖੇਡਣਾ ਮਨ ਕਾ ਚਾਓ ਪੂਰਾ ਕਰਨਾ ਹਰੇਕ ਬੰਦੇ ਦਾ ਜਾਣੀ ਕੇ ਖੇਡਾਂ ਇੱਕ ਬਹੁਤ ਹੀ ਆਪਣੇ ਹਰੇਕ ਕਿੱਤੇ ਨੂੰ ਉੱਪਰ ਚੁੱਕਦੀਆਂ ਹਨ ਖੇਡਾਂ ਨਾਲ ਬੰਦੇ ਨੂੰ ਰੁਜ਼ਗਾਰ ਦੀ ਵੀ ਪ੍ਰਾਪਤੀ ਹੁੰਦੀ ਹੈ ਫਾਈਨਾਸ ਤੌਰ 'ਤੇ ਉਸਦੀ ਮਤਲਬ ਕਈ ਮਸਲੇ ਵੀ ਹੱਲ ਕਰਦੀ ਹੈ ਇਸ ਨਾਲ ਲੋਕ ਖੇਡਾਂ ਨਾਲ ਜੁੜੇ ਰਹਿੰਦੇ ਹਨ ਖੇਡਾਂ ਦੇ ਤਾਂ ਬਹੁਤ ਲਾਭ ਹੁੰਦੇ ਹਨ